ਸਾਡੇ ਖੇਤਰ ਦੇ ਵਿੱਚ ਜਿਹੜੇ ਲੋਕਾਂ ਨੂੰ ਜਮੀਨ ਖਰੀਦਣ ਜਾਂ ਵੇਚਣ ਵੇਲੇ ਬਹੁਤ ਸਾਰੀਆਂ ਮੁਸ਼ਕਿਲਾਂ ਪੇਸ਼ ਕਰਨੀਆਂ ਪੈਂਦੀਆਂ ਨੇ ਜਿਵੇਂ ਬਹੁਤ ਵਾਰੀ ਜਿਹੜੇ ਪਟਵਾਰੀ ਨੇ ਉਹ ਸਟ੍ਰਾਈਕ ਕਰ ਦਿੰਦੇ ਹੈਗੇ ਰਜਿਸਟਰੀਆਂ ਨਹੀਂ ਟਾਈਮ ਨਾਲ ਹੁੰਦੀਆਂ ਮਤਲਬ ਜਿਹੜੇ ਕੋ ਤਹਿਸੀਲਾਂ ਨੇ ਉੱਥੇ ਬਹੁਤ ਸਾਰੀ ਭੀੜ ਹੁੰਦੀ ਹੈਗੀ ਤਾਂ ਇਸ ਤਰੀਕੇ ਨਾਲ ਜਿਹੜੇ ਲੋਕ ਜਿਹੜੇ ਖੱਜਲ ਖਵਾਰ ਹੁੰਦੇ ਹੈਗੇ ਐਵੇਂ ਹੁਣ ਇਸ ਤਰੀਕੇ ਦੀ ਉਹਨਾਂ ਨੂੰ ਜਿਹੜੀਆਂ ਮੁਸ਼ਕਿਲਾਂ ਪੇਸ਼ ਕਰਨੀਆਂ ਪੈਂਦੀਆਂ ਨੇ